ਅੱਜ ਕੱਲ੍ਹ ਸਾਡੇ ਖੇਤਰ ਵਿੱਚ ਖੁਦਕੁਸ਼ੀ ਦੀ ਗੱਲ ਆਏ ਦਿਨ ਅਖ਼ਬਾਰਾਂ ਵਿੱਚ ਦਿਖਦੀ ਰਹਿੰਦੀ ਹੈ ਇਹ ਬੜੇ ਦੁੱਖ ਦੀ ਗੱਲ ਹੈ ਜਿਹੜਾ ਬੰਦਾ ਕਿਸਾਨ ਸਾਰੇ ਦੇਸ਼ ਨੂੰ ਅਨਾਜ ਪੈਦਾ ਕਰਕੇ ਉਹਦਾ ਢਿੱਡ ਭਰਦਾ ਹੈਗਾ ਉਹ ਖ਼ੁਦਕੁਸ਼ੀ ਕਰਨ ਵਾਸਤੇ ਮਜ਼ਬੂਰ ਹੋ ਰਿਹਾ ਹੈ ਇਹਦਾ ਇੱਕ ਮੂਲ ਕਾਰਨ ਹੈ ਜਿਹੜਾ ਆੜ੍ਹਤੀ ਤੋਂ ਉਹਨੇ ਕਰਜ਼ਾ ਲਿੱਤਾ ਹੈ ਇਹ ਕਰਜ਼ਾ ਬਹੁਤ ਹੀ ਜ਼ਿਆਦਾ ਵਿਆਜ 'ਤੇ ਹੁੰਦਾ ਅਤੇ ਉਹ ਬੇਚਾਰਾ ਮੌਸਮ ਦੀ ਮਾਰ ਕਰਕੇ ਕਰਜ਼ਾ ਚੁਕਾ ਨਹੀਂ ਸਕਦਾ ਇਹ ਕਰਜ਼ਾ ਦਾ ਵਿਆਜ ਚੱਕਰਵਰਤੀ ਹੁੰਦਾ ਹੈ ਜਿਹੜਾ ਵੱਧਦਾ ਜਾਂਦਾ ਹੈ ਸਰਕਾਰ ਨੂੰ ਸਸਤੇ ਕਰਜ਼ ਦਿਲਾਉਣ ਦੀ ਕੋਈ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ ਜਿਹੜਾ ਬੈਂਕਾਂ ਰਾਹੀਂ ਇਹਨਾਂ ਨੂੰ ਆਰਾਮ ਨਾਲ ਕਰਜ਼ਾ ਮਿਲ ਸਕੇ ਅਤੇ ਨਾਲ ਜਿਹੜੇ ਗ੍ਰਾਮ ਪੰਚਾਇਤ ਅਤੇ ਪ੍ਰਧਾਨ ਹੈਗੇ ਉਹਨਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਜਿਹੜਾ ਇੱਦਾਂ ਦਾ ਕੋਈ ਬੰਦਾ ਹੋਵੇ ਜਿਸ 'ਤੇ ਬਹੁਤ ਜ਼ਿਆਦਾ ਕਰਜ਼ੇ ਦਾ ਬੋਝ ਹੋ ਗਿਆ ਹੈ ਉਹਦੀ ਮਦਦ ਕਰਨ ਅਤੇ ਉਹ ਖ਼ੁਦਕੁਸ਼ੀ ਨਾ ਕਰੇ